ਭਾਰਤੀ ਮੀਡੀਆ ਬਹੁਤ ਚੰਗਾ ਹੈ ਅਤੇ ਸਾਨੂੰ ਹਰ ਤਰ੍ਹਾਂ ਦੀ ਨਿਊਜ਼ ਪਾਉਂਦਾ ਹੈ ਇਹ ਹਰ ਸ਼ਹਿਰ ਦੀ ਹਰ ਸੂਬੇ ਦੀ ਹਰ ਦੇਸ਼ ਦੀ ਅਤੇ ਹਰ ਮਾੜੇ ਅਤੇ ਚੰਗੇ ਨਾਗਰਿਕ ਦੀ ਸਾਨੂੰ ਹਰ ਖ਼ਬਰ ਦਿਖਾਉਂਦੇ ਹਨ ਅਤੇ ਬਹੁਤ ਚੰਗਾ ਮੀਡੀਆ ਹੈ ਇਹ ਸਹੀ ਤੱਥ ਵਿਖਾਉਂਦੇ ਹਨ ਅਤੇ ਕੋਈ ਐਕਸੀਡੈਂਟ ਬਾਰੇ ਜਾਂ ਕਿਸੇ ਵੀ ਸੂਬੇ ਦੇ ਕਿਸੇ ਗਲਤ ਕੰਮਾਂ ਬਾਰੇ ਸਾਨੂੰ ਵਿਖਾਇਆ ਜਾਂਦਾ ਹੈ ਅਤੇ ਸਾਨੂੰ ਪੋਲੀਟਿਕਸ ਅਤੇ ਸਾਰੇ ਸੂਬਿਆਂ ਵਿੱਚ ਹੋਣ ਵਾਲੀਆਂ ਸਾਰੀਆਂ ਗਲਤ ਅਤੇ ਚੰਗੀਆਂ ਖ਼ਬਰਾਂ ਸਾਨੂੰ ਵਿਖਾਉਂਦਾ ਹੈ ਅਤੇ ਅਸੀਂ ਉਹਨਾਂ ਨੂੰ ਸਵੇਰੇ ਉੱਠ ਕੇ ਸੁਣਦੇ ਹਾਂ ਅਤੇ ਅਸੀਂ ਨਿਊਜ਼ ਚੈਨਲ ਦੇਖਦੇ ਹਾਂ ਜੀ ਨਿਊਜ਼ ਆਜ ਤੱਕ ਅਤੇ ਅਖ਼ਬਾਰਾਂ ਅਸੀਂ ਪੜ੍ਹਦੇ ਹਾਂ ਪੰਜਾਬੀ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਅਤੇ ਚੜਦੀ ਕਲਾ ਅਤੇ ਸਾਡਾ ਮੀਡੀਆ ਬਹੁਤ ਚੰਗਾ ਹੈ ਅਤੇ ਸਹੀ ਤੱਤ ਵਿਖਾਉਂਦਾ ਹੈ ਅਤੇ ਢੁੱਕਵੀਆਂ ਖ਼ਬਰਾਂ ਵੀ ਦਿੰਦਾ ਹੈ